ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਖੇਡਾਂ ਵਿੱਚ ਕਈ ਖਿਡਾਰੀ ਸਫਲ ਹੁੰਦੇ ਆ ਅਤੇ ਕਈ ਅਸਫਲ ਹੁੰਦੇ ਆ ਜਾਂ ਮੰਨ ਲਓ ਕੋਈ ਮੈਚ ਖੇਡਦਾ ਆ ਉਹਦੇ ਵਿੱਚ ਅਸਫਲ ਹੋ ਗਿਆ ਹਾਰ ਗਿਆ ਜਾਂ ਮੰਨ ਲਓ ਅਤੇ ਉਹਦੇ ਤੋਂ ਕਈ ਵਾਰ ਉਹ ਸਿੱਖਦਾ ਵੀ ਹਾਂ ਕਿ ਕਿਹੜਿਆਂ ਕਾਰਣ ਕਰਕੇ ਜਿਹੜੀਆਂ ਮੇਰੀਆਂ ਗਲਤੀਆਂ ਸੀਗੀਆਂ ਜਾਂ ਕੀ ਕਾਰਣ ਬਣੇ ਜਿਹਨਾਂ ਕਰਕੇ ਅਸੀਂ ਮੈਚ ਹਾਰੇ ਸੋ ਖਿਡਾਰੀ ਉਸ ਅਸਫਲਤਾ ਤੋਂ ਸਫਲਤਾ ਦੇ ਵੱਲ ਜਾਂਦਾ ਉਹ ਅਗਾਂਹ ਅਗਲਾ ਮੈਚ ਜਦੋਂ ਵੀ ਖੇਡਦਾ ਆ ਤਾਂ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਦਾ ਇਸ ਕਰਕੇ ਅਸਫਲਤਾ ਤੋਂ ਉਹ ਸਫਲਤਾ ਦੇ ਰਾਸਤੇ ਵੱਲ ਜਾਂਦਾ ਕਈ ਵਾਰ ਜਿਹੜੀ ਆ ਸਫਲਤਾ ਜਿਹੜੀ ਆ ਉਹ ਸਾਨੂੰ ਅਸਫਲਤਾ ਵੱਲ ਵੀ ਲੈ ਜਾਂਦੀ ਆ ਉਹ ਕਿਵੇਂ ਲੈ ਜਾਂਦੀ ਆ ਉਹਦਾ ਮਤਲਬ ਇਹ ਆ ਜਿਹੜਾ ਖਿਡਾਰੀ ਮੈਚ ਇੱਕ ਵਾਰ ਜਿੱਤ ਗਿਆ ਸਫਲ ਹੋ ਗਿਆ ਪਹਿਲੀ ਵਾਰ ਉਹਦੇ ਵਿੱਚ ਹੰਕਾਰ ਆ ਗਿਆ ਕਿ ਹਾਂ ਮੇਰੇ ਤੋਂ ਵਧੀਆ ਤਾਂ ਕੋਈ ਹੈ ਹੀ ਨਹੀਂ ਮੇਰੇ ਤੋਂ ਚੰਗਾ ਤਾਂ ਕੋਈ ਖੇਡ ਹੀ ਨਹੀਂ ਸਕਦਾ ਸੋ ਇਹਨਾਂ ਕਾਰਣਾਂ ਦੇ ਕਰਕੇ ਇਸ ਉਹਦੇ ਭਰਮ ਦਾ ਕਰਕੇ ਕਈ ਵਾਰ ਸਫਲ ਖਿਡਾਰੀ ਵੀ ਜਿਹੜੇ ਉਹ ਅਸਫਲਤਾ ਦੇ ਰਾਹ 'ਤੇ ਪੈ ਜਾਂਦੇ ਆ ਉਹਨਾਂ ਨੂੰ ਜਿਹੜਾ ਆ ਹਾਰ ਦਾ ਸਾਹਮਣਾ ਕਰਨਾ ਪੈਂਦਾ ਆ ਸੋ ਇਸ ਕਰਕੇ ਸਫਲਤਾ ਅਤੇ ਅਸਫਲਤਾ ਜਿਹੜੀ ਆ ਦੋਵੇਂ ਚੀਜ਼ਾਂ ਹੀ ਖਿਡਾਰੀਆਂ ਵਾਸਤੇ ਬਹੁਤ ਮਾਇਨੇ ਰੱਖਦੀਆਂ ਆ ਬਹੁਤ ਹੀ ਮਾਇਨੇ ਰੱਖਦੀਆਂ ਖੇਡਾਂ ਵਿੱਚ ਹੋਰ ਬਿਹਤਰੀ ਕਰਨ ਵਿੱਚ ਸਫਲਤਾ ਅਤੇ ਅਸਫਲਤਾ ਦੋਵੇਂ ਹੀ ਬਹੁਤ ਲਾਹੇਵੰਦ ਹੈ